ਮੈਂ ਜਲੰਧਰ ਸ਼ਹਿਰ ਦੇ ਵਿੱਚ ਰਹਿਣ ਵਾਲੀ ਹਾਂ ਸਾਡੇ ਖੇਤਰ ਦੇ ਵਿੱਚ ਇੱਥੇ ਕੋ ਪੰਛੀ ਕੋਈ ਵੀ ਸੈਂਚਰੀਆਂ ਬਰਡ ਸੈਂਚਰੀਆਂ ਵਗੈਰਾ ਨਹੀਂ ਹੈਗੀਆਂ ਅਤੇ ਉਂਜ ਪਰ ਮੈਨੂੰ ਬਹੁਤ ਸ਼ੌਕ ਆ ਬਰਡਸ ਮਤਲਬ ਸੈਂਚਰੀਆਂ ਦੇਖਣ ਦਾ ਮੈਂ ਕਈ ਸੈਂਚਰੀਆਂ ਦੇ ਵਿੱਚ ਗਈ ਹਾਂ ਪਰ ਮੈਂ ਉੱਥੇ ਬਹੁਤ ਹੀ ਸਾਰੇ ਪੰਛੀ ਜਿਹੜੇ ਆ ਉਹ ਦੇਖੇ ਨੇ ਅਤੇ ਸਾਡੇ ਇੱਥੇ ਇਰਧ ਗਿਰਧ ਮੈਂ ਜਾਂ ਕਈ ਵਾਰੀ ਨਿੱਕੂ ਪਾਰਕ ਕੰਪਨੀ ਬਾਗ ਪਲਟਨ ਪਾਰਕ ਇੱਥੇ ਜਾਂਦੀ ਹਾਂ ਇੱਥੇ ਕਈ ਪੰਛੀ ਵਗੈਰਾ ਦੇਖਣ ਵਾਸਤੇ ਜਾਂਦੀ ਹਾਂ ਕਿਉਂਕਿ ਮੈਨੂੰ ਪੰਛੀ ਦੇਖਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਕਈ ਵਾਰੀ ਨਿੱਕੂ ਪਾਰਕ ਦੇ ਵਿੱਚ ਬਾਜ ਮੋਰ ਕੁੰਚ ਕਮਾਈ ਕੁੱਕੜ ਕਾਲ ਕਲੀਚੀ ਕਾਲਾ ਤਿੱਤਰ ਕਾਲਾ ਕਾਲੀ ਗਾਲੜੀ ਕਿਲਕਲਾ ਗਾਨੀ ਵਾਲੀ ਘੁੱਗੀ ਵਗੈਰਾ ਬੱਤਖ ਕਈ ਜਾਨਵਰ ਜਿਹੜੇ ਆ ਇਹੋ ਜਿਹੇ ਦੇਖੇ ਨੇ ਜਿਹੜੇ ਕਿ ਬਹੁਤ ਹੀ ਮੈਨੂੰ ਵਧੀਆ ਲੱਗਦੇ ਨੇ ਅਤੇ ਮੈਂ ਹਮੇਸ਼ਾ ਉਹਨਾਂ ਨੂੰ ਦੇਖਣ ਵਾਸਤੇ ਸੈਂਚਰੀਆਂ ਦੇ ਵਿੱਚ ਜਾਂਦੀ ਰਹਿੰਦੀ ਹਾਂ ਅਤੇ ਸਾਡੇ ਆਲੇ ਦੁਆਲੇ ਵੀ ਕਈ ਪਾਰਕ ਨੇ ਮੈਂ ਅਦਰਸ਼ ਨਗਰ ਦੇ ਵਿੱਚ ਰਹਿੰਦੀ ਹਾਂ ਉੱਥੇ ਦੋ ਤਿੰਨ ਪਾਰਕ ਹੈਗੇ ਨੇ ਕੋਲ ਕੋਲ ਮੈਂ ਉੱਥੇ ਜਾ ਕੇ ਕਈ ਵਾਰੀ ਪੰਛੀਆਂ ਨੂੰ ਦੇਖਦੀ ਹਾਂ ਉੱਥੇ ਕਈ ਮਤਲਬ ਬਾਜ ਵਗੈਰਾ ਆਉਂਦੇ ਨੇ ਕਈ ਚਿੜੀਆਂ ਵਗੈਰਾ ਚਹਿ ਚਹਾਉਂਦੀਆਂ ਰਹਿੰਦੀਆਂ ਨੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਆ ਅਤੇ ਜਿਹੜਾ ਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ